ਸਤਿ ਸ਼੍ਰੀ ਅਕਾਲ ਮੈਮ ਤੁਸੀਂ ਬਿਜਲੀ ਵਿਭਾਗ ਤੋਂ ਗੱਲ ਕਰ ਰਹੇ ਹੋ ਮੈਮ ਮੈਨੂੰ ਪਤਾ ਹੈ ਕਿ ਮੇਰਾ ਮੇਰੇ ਬਿਜਲੀ ਦਾ ਬਿੱਲ ਜਿਹੜਾ ਹੈਗਾ ਉਹ ਪੈਂਡਿੰਗ ਹੈ ਮੇਰੇ ਘਰ ਦੀ ਸਥਿਤੀ ਕੁਝ ਇੰਨੀ ਸਹੀ ਨਹੀਂ ਸੀ ਤਾਂ ਮੇਰੀ ਜੋਬ ਚਲੀ ਗਈ ਸੀ ਹੁਣ ਮੈਂ ਨਵੀਂ ਜੋਬ ਲਈ ਅਪਲਾਈ ਕੀਤਾ ਹੈ ਅਤੇ ਉਹਦਾ ਮੈਨੂੰ ਆਫਰ ਲੈਟਰ ਆ ਜਾਏਗਾ ਥੋੜ੍ਹੇ ਟਾਈਮ ਤੱਕ ਅਤੇ ਮੈਂ ਤੁਹਾਨੂੰ ਜਲਦੀ ਹੀ ਤੁਹਾਨੂੰ ਮੈਂ ਤੁਹਾਡੇ ਬਿਜਲੀ ਬਿੱਲ ਦਾ ਬਿਜਲੀ ਬਿੱਲ ਦਾ ਭੁਗਤਾਨ ਮੈਂ ਕਰ ਦੂੰਗੀ ਆਪ ਅਤੇ ਮੈਂ ਮੇਰੀ ਇਹ ਅਰਜ਼ੀ ਹੈ ਕਿ ਤੁਸੀਂ ਮੇਰੇ ਬਿਜਲੀ ਬਿਜਲੀ ਬਿੱਲ ਵਿੱਚ ਕੋਈ ਵੀ ਕੋਈ ਵੀ ਊਚ ਨੀਚ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਮਤਲਬ ਮੇਰਾ ਬਿਜਲੀ ਦਾ ਬਿੱਲ ਕੱਟਿਆ ਜਾਵੇ ਅਤੇ ਮੈਮ ਮੈਂ ਤੁਹਾਨੂੰ ਜਦੋਂ ਹੀ ਮੇਰਾ ਮੇਰਾ ਜੋਬ ਦਾ ਹੋ ਜਾਏਗਾ ਮੈਂ ਤੁਹਾਨੂੰ ਸਾਰੀ ਪੇਮੈਂਟ ਆਪ ਹੀ ਕਰੂੰਗੀ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਹੋਰ ਕੀ ਵਿਕਲਪ ਹੋ ਸਕਦੇ ਆ ਤਾਂ ਕਿ ਮੇਰੇ ਬਿਜਲੀ ਵਿੱਚ ਕੋਈ ਬਿਜਲੀ ਬਿਜਲੀ ਵਿੱਚ ਵੀ ਕੋਈ ਵੀ ਕੋਈ ਵੀ ਡਿਸਟਰਬੈਂਸ ਨਾ ਹੋਵੇ